ਅਠਾਈ ਸਤੰਬਰ ਉੱਨੀ ਸੌ ਨੜਿਨਵੇਂ ਦੋ ਜੂਨ ਉੱਨੀ ਸੌ ਅਠਤਾਲੀ ਪੰਜ ਸਤੰਬਰ ਉੱਨੀ ਸੌ ਪਚਾਨਵੇਂ ਸੱਤ ਅਗਸਤ ਦੋ ਹਜ਼ਾਰ ਦੋ ਸਤਾਰ੍ਹਾਂ ਅਗਸਤ ਦੋ ਹਜ਼ਾਰ ਇੱਕ